ਸਤਿ ਸ਼੍ਰੀ ਅਕਾਲ ਮੈਮ ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਜ਼ਰਾ ਤੋਂ ਬ ਬੋਲ ਰਹੀ ਹਾਂ ਤੁਹਾਡਾ ਬੇਟਾ ਹਰਪ੍ਰੀਤ ਸਿੰਘ ਸਾਡੇ ਸਕੂਲ ਦੇ ਵਿੱਚ ਪੜ੍ਹਦਾ ਮੈਂ ਉਨ੍ਹਾਂ ਦੀ ਕਲਾਸ ਟੀਚਰ ਬੋਲ ਰਹੀ ਹਾਂ ਐਕਚੁਲੀ ਉਹਨਾਂ ਨੂੰ ਨਾ ਸੈਕਿੰਡ ਪੀਰੀਅਡ ਦੇ ਵਿੱਚ ਬੁਖਾਰ ਚੜ੍ਹ ਗਿਆ ਮਤਲਬ ਕਾਫੀ ਸਾਰਾ ਬੁਖਾਰ ਹੋ ਹਮ ਜ਼ਿਆਦਾ ਬੁਖਾਰ ਹੋ ਗਿਆ ਉਹਨਾਂ ਨੂੰ ਕੀ ਤੁਸੀਂ ਉਹਨਾਂ ਨੂੰ ਆ ਕੇ ਲੈ ਕੇ ਜਾ ਸਕਦੇ ਹੋ ਨਹੀਂ ਮੈਮ ਹਲੇ ਤਾਂ ਠੀਕ ਹੈ ਇੱਥੇ ਵੈਸੇ ਹੈਗੀ ਸੀਗੀ ਮੈਂ ਪੀ ਸੀ ਐਮ ਦੇ ਤੀ ਉਦੋਂ ਬੱਚੇ ਨੂੰ ਥੋੜ੍ਹਾ ਜਿਹਾ ਠੀਕ ਹੈ ਬਟ ਉਹਦੀ ਜ਼ਿਆਦਾ ਸਿਹਤ ਖਰਾਬ ਨਾ ਹੋਵੇ ਤਾਂ ਕਰਕੇ ਤੁਸੀਂ ਉਹਨੂੰ ਘਰ ਲੈ ਜਾਉ ਅਤੇ ਡਾਕਟਰ ਨੂੰ ਦਿਖਾ ਦਿਉ ਤਾਂ ਕਿ ਉਹਨੂੰ ਜ਼ਿਆਦਾ ਸਿਹਤ ਖਰਾਬ ਨਾ ਹੋ ਜਾਵੇ ਉਹਦੀ

ਹਾਂਜੀ ਹਾਂਜੀ ਮੈਮ ਅਸੀਂ ਉਹਨਾਂ ਨੂੰ ਰੈਸਟ ਰੂਮ ਦੇ ਵਿੱਚ ਪਾਇਆ ਹੋਇਆ ਰੈਸਟ ਕਰ ਰਿਹਾ ਅਤੇ ਤੁਸੀਂ ਥੋੜ੍ਹਾ ਜਲਦੀ ਆ ਜਾਉ ਅਤੇ ਕੌਣ ਆ ਰਿਹਾ ਮੈਨੂੰ ਉਹਨਾਂ ਦੀ ਡਿਟੇਲ ਦੱਸ ਦਿਉ ਕੌਣ ਆ ਰਿਹਾ ਤਾਂ ਕਿ ਮੈਂ ਰਿਸੈਪਸ਼ਨ 'ਤੇ ਦੇ ਦੇਵਾਂ ਅਤੇ ਜਦੋਂ ਕੋਈ ਆਏਗਾ ਤਾਂ ਉਹ ਬੱਚੇ ਨੂੰ ਲੈ ਜਾਵੇਗਾ ਹਾਂਜੀ ਓਕੇ ਮੈਮ ਥੋੜ੍ਹਾ ਜਲਦੀ ਆ ਜਾਉ ਤਾਂ ਕਿ ਉਹਨੂੰ ਡਾਕਟਰ ਕੋਲ ਲੈ ਜਾਉ ਬੱਚੇ ਨੂੰ ਹਾਂਜੀ ਹਾਂ ਹਾਂਜੀ ਰਿਸੈਪਸ਼ਨ 'ਤੇ ਆ ਕੇ ਬੱਚੇ ਦਾ ਨਾਮ ਦੱਸ ਦਿਓ ਤਾਂ ਅੱਗੇ ਜਿਹੜੇ ਟੀਚਰ ਹੈ ਉਹ ਬੱਚੇ ਨੂੰ ਤੁਹਾਡੇ ਤੱਕ ਪਹੁੰਚਾ ਦੇਣਗੇ ਓਕੇ ਮੈਮ